ਮੇਰੀ ਕੰਮ ਵਾਲੀ ਥਾਂ 'ਤੇ ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਬਟ ਕਈ ਇਹ ਜਿਹੀਆਂ ਦਿੱਕਤਾਂ ਨੇ ਜਿਹੜੀਆਂ ਕਿ ਮੈ ਤੁਹਾਨੂੰ ਦੱਸਾਂਗੀ ਅਤੇ ਉਹ ਨੇ ਜਿੱਦਾਂ ਕਿ ਮੈਨੂੰ ਘਰ ਤੋਂ ਜਾਣਾ ਪੈਂਦਾ ਹੈ ਅਤੇ ਰਸਤੇ 'ਚ ਬੱਸਾਂ 'ਚ ਧੱਕੇ ਖਾਣੇ ਪੈਂਦੇ ਨੇ ਅਤੇ ਹੁਣ ਤਾਂ ਮੈਂ ਐਕਟਿਵਾ ਲੈ ਲਈ ਹੈ ਅਤੇ ਰਸਤੇ 'ਚ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਅਤੇ ਟਾਈਮ 'ਤੇ ਪੁੱਜਣਾ ਵੀ ਹੁੰਦਾ ਹੈ ਅਤੇ ਉੱਥੇ ਜਾ ਕੇ ਪਾਰਕਿੰਗ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਪਾਰਕਿੰਗ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਇਸ ਕਰਕੇ ਮੈਂ ਟਾਈਮ ਜੀ ਜਿਹੜਾ ਕਿ ਮੈ ਤੋਂ ਲੇਟ ਪਹੁੰਚਿਆ ਜਾਂਦਾ ਹੈ ਅਤੇ ਉੱਥੇ ਕੰਮ ਕਰਦੇ ਵੇਲੇ ਜਿਹੜਾ ਕਿ ਕੰਪਿਊਟਰ 'ਤੇ ਕੰਮ ਹੁੰਦਾ ਹੈ ਅਤੇ ਕੰਪਿਊਟਰ ਬੰਦ ਹੋ ਜਾਂਦਾ ਹੈ ਲਾਈਟ ਚਲੇ ਜਾਂਦੀ ਹੈ ਅਤੇ ਕੰਮ ਉੱਥੇ ਰੁੱਕ ਹੈ ਅਤੇ ਉੱਦਾਂ ਹੀ ਫਿਰ ਕੰਮ ਲੇਟ ਹੋਈ ਜਾਂਦਾ ਆ ਅਤੇ ਕਸਟਮਰ ਜਿਹੜੇ ਹੁੰਦੇ ਨੇ ਅਤੇ ਉਹ ਲਾਈਨ ਵਿੱਚ ਨਹੀਂ ਆਉਂਦੇ ਜਿਸ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਹੈ ਅਤੇ ਕਸਟਮਰ ਆਪਣੀ ਗੱਲ ਇੱਧਰ ਉਧਰ ਫੋਰਮ ਗਲਤ ਭਰਾ ਹੋ ਜਾਂਦੇ ਨੇ ਫਿਰ ਉਹ ਤੋਂ ਬਾਅਦ ਕਸਟਮਰ ਨੂੰ ਵੀ ਦਿੱਕਤ ਅਤੇ ਸਾਨੂੰ ਵੀ ਦਿੱਕਤ ਅਤੇ ਜਿਹੜਾ ਮੇਰਾ ਬੋਸ ਹੈ ਉਹ ਬਹੁਤ ਜ਼ਿਆਦਾ ਗੁੱਸੇ ਵਾਲ਼ੇ ਨੇ ਅਤੇ ਉਹਨਾਂ ਦਾ ਬਹੁਤ ਜ਼ਿਆਦਾ ਉਹ ਕੰਮ ਦਿੰਦੇ ਰਹਿੰਦੇ ਨੇ ਅਤੇ ਜਦ ਤੱਕ ਅਸੀਂ ਆਪਣਾ ਕੰਮ ਨਾ ਪੂਰਾ ਕਰੀਏ ਸਾਨੂੰ ਘਰ ਨਹੀਂ ਜਾਣ ਦਿੰਦੇ ਇਸ ਕਰਕੇ ਕਈ ਵਾਰ ਮੈਨੂੰ ਰਾਤ ਵੀ ਹੋ ਜਾਂਦੀ ਹੈ ਜਿਸ ਕਰਕੇ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਅਤੇ ਇੱਦਾਂ ਦੀਆਂ ਬਹੁਤ ਜ਼ਿਆਦਾ ਦਿੱਕਤਾਂ ਨੇ ਜਿਹੜੀਆਂ ਕਿ ਆਉਂਦੀਆਂ ਨੇ ਅਤੇ ਧੰਨਵਾਦ